ਹੈਲੋ ਸਤਿ ਸ਼੍ਰੀ ਅਕਾਲ ਸਰ ਸਰ ਮੈਂ ਅਰਵਿੰਦ ਭਾਰਦਵਾਜ ਪਠਾਨਕੋਟ ਤੋਂ ਬੋਲਦਾ ਪਿਆ ਅਤੇ ਮੈਂ ਤੁਹਾਡੇ ਕੋਲ ਕੈਬ ਬੁੱਕ ਕਰਵਾਈ ਸੀ ਅਤੇ ਮੇਰਾ ਅੱਜ ਐਨ ਡੀ ਏ ਦਾ ਪੇਪਰ ਹੈਗਾ ਅਤੇ ਅੰਮ੍ਰਿਤਸਰ ਮੇਰਾ ਪੇਪਰ ਹੈਗਾ ਅਤੇ ਮੈਂ ਤੁਹਾਡੇ ਕੋਲ ਕੈਬ ਬੁੱਕ ਕਰਵਾਈ ਸੀ ਪਠਾਨਕੋਟ ਤੋਂ ਅੰਮ੍ਰਿਤਸਰ ਮੈਨੂੰ ਮੈਂ ਬੱਸ ਸਟੈਂਡ ਦਾ ਖੜ੍ਹਾ ਹੈਗਾ ਸਾਢੇ ਸੱਤ ਦਾ ਅਤੇ ਹੁਣ ਇੱਕ ਘੰਟਾ ਹੋ ਗਿਆ ਮੈਂ ਸਾਢ਼ੇ ਅੱਠ ਹੋ ਗਏ ਆ ਅਤੇ ਤੁਸੀਂ ਮੈਨੂੰ ਸਾਢੇ ਸੱਤ ਦਾ ਟਾਈਮ ਦਿੱਤਾ ਸੀਗਾ ਕਿ ਸਾਢੇ ਸੱਤ ਮੈਂ ਬੱਸ ਸਟੈਂਡ ਪਹੁੰਚ ਜਾਵਾਂਗਾ ਅਤੇ ਅਜੇ ਤੱਕ ਤੁਸੀਂ ਬੱਸ ਸਟੈਂਡ ਨਹੀਂ ਪੁੱਜੇ ਮੈਨੂੰ ਕਿਰਪਾ ਕਰਕੇ ਇਹ ਦੱਸਿਆ ਜਾਵੇ ਕਿ ਤੁਸੀਂ ਜੇ ਤੁਸੀਂ ਆਉਣਾ ਜਾਂ ਨਹੀਂ ਮੈਨੂੰ ਇਹ ਵੀ ਦੱਸਿਆ ਜਾਵੇ ਜਾਂ ਤੁਸੀਂ ਕੋਈ ਟਰੈਫਿਕ ਵਿੱਚ ਫਸੇ ਦੇ ਹੋ ਮੈਨੂੰ ਇਹ ਵੀ ਦੱਸਿਆ ਜਾਵੇ ਕਿ ਮੈਂ ਜੇ ਤੁਸੀਂ ਨਹੀਂ ਵੀ ਆਉਣਾ ਮੈਂ ਕੋਈ ਹੋਰ ਕੈਬ ਬੁਕ ਕਰ ਕਰਕੇ ਮੈਂ ਆਪਣਾ ਪੇਪਰ ਦੇਣ ਜਾਵਾਂ ਕਿਉਂਕਿ ਮੈਂ ਆਪਣੇ ਪੇਪਰ ਦੇ ਲਈ ਬਹੁਤ ਹੀ ਜ਼ਿਆਦਾ ਮਿਹਨਤ ਕੀਤੀ ਦੀ ਆ ਅਤੇ ਮੈਂ ਆਪਣੇ ਫਿਊਚਰ ਲਈ ਬੜਾ ਸਿਕਿਓਰ ਹੈਗਾ ਅਤੇ ਤਾਂ ਕਰਕੇ ਮੈਨੂੰ ਉਹ ਟੈਂਸ਼ਨ ਹੋ ਰਹੀ ਹੈ ਕਿ ਜੇ ਤੁਸੀਂ ਨਾ ਆਏ ਮੈਂ ਉੱਥੇ ਦੇਰ ਨਾਲ ਪੁੱਜਿਆ ਅਤੇ ਤਾਂ ਕਰਕੇ ਮੇਰੀ ਜ਼ਿੰਦਗੀ ਲਾਈਫ ਖਰਾਬ ਹੋ ਸਕਦੀ ਹੈ ਤਾਂ ਕਰਕੇ ਮੈਨੂੰ ਜਲਦ ਤੋਂ ਜਲਦ ਦੱਸਿਆ ਜਾਵੇ ਕਿ ਤੁਸੀਂ ਕਿੰਨੀ ਦੇਰ ਤੱਕ ਆ ਸਕਦੇ ਹੋ ਜੇ ਤੁਹਾਨੂੰ ਮੇਰੀ ਲੋਕੇਸ਼ਨ ਦਾ ਨਹੀਂ ਵੀ ਪਤਾ ਤਾਂ ਮੈਂ ਤੁਹਾਨੂੰ ਇਹ ਨੰਬਰ 'ਤੇ ਨਾ ਆਪਣੀ ਲੋਕੇਸ਼ਨ ਵੀ ਪਾ ਸਕਦਾ ਕਿ ਤੁਸੀਂ ਜਲਦ ਤੋਂ ਜਲਦ ਮੇਰੇ ਤੱਕ ਪਹੁੰਚ ਸਕੋ ਅਤੇ ਥੈਂਕ ਯੂ ਸਰ